ਸ਼੍ਰੀ ਹਜ਼ੂਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਜਾਣਾ ਚਾਹੁੰਦੇ ਹੈ ਕਿ ਉੱਥੇ ਬੜੀ ਵਧੀਆ ਧਰਤੀ ਹੈ ਗੁਰੂਆਂ ਦੀ ਅਤੇ ਦਮਦਮਾ ਸਾਹਿਬ ਦਮਦਮਾ ਸਾਹਿਬ ਵੀ ਮੈਂ ਜਾਣਾ ਚਾਹੁੰਦੀ ਹਾਂ ਤੀਰਥ ਯਾਤਰਾ 'ਤੇ ਸਾਬੋ ਦੀ ਤਲਵੰਡੀ ਉੱਥੇ ਵੀ ਅਸੀਂ ਜਾਣਾ ਚਾਹੁੰਦੇ ਹਾਂ ਕਿ ਕਈ ਬੁਢੇਪੇ 'ਚ ਆ ਕੇ ਮਨ ਦੀ ਤਮੰਨਾ ਪੂਰੀ ਹੋ ਜਾਵੇ ਹੈ ਨਾ ਸ੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਵੀ ਯਾਤਰਾ ਕਰਨੀ ਚਾਹੁੰਦੇ ਹਾਂ ਸ਼੍ਰੀ ਹੇਮਕੁੰਟ ਸਾਹਿਬ ਵੀ ਜਾਣਾ ਚਾਹੁੰਦੇ ਹਾਂ ਕਿ ਯਾਤਰਾ ਤੀਰਥ ਯਾਤਰਾ ਦੀ ਮਨੋਕਾਮਨਾ ਪੂਰੀ ਹੋ ਜਾਵੇ